ਜੇਕਰ ਮੈਂ ਆਪਣੇ ਜੀਵਨ ਦੇ ਹੋਰ ਪਹਿਲੂਆਂ ਦੀ ਗੱਲ ਕਰਾਂ ਅਤੇ ਮੈਂ ਉਨ੍ਹਾਂ ਨੂੰ ਬੜੀ ਸਾਦਗੀ ਨਾਲ ਸੰਗੀਤ ਦੇ ਨਾਲ ਮੈਨੇਜ ਕਰਦਾ ਵਾ ਜੇਕਰ ਮੈਂ ਸਵੇਰੇ ਪੜ੍ਹਦਾ ਵੀ ਹਾਂ ਅਤੇ ਸ਼ਾਮ ਨੂੰ ਮੈਂ ਆਪਣਾ ਰਿਹਾਜ਼ ਵੀ ਕਰ ਲੈਂਦਾ ਵਾਂ ਜੇਕਰ ਗੱਲ ਕੀਤੀ ਜਾਵੇ ਮੇਰੇ ਪੈਸ਼ਨ ਦੇ ਬਾਰੇ ਮੈਨੂੰ ਹਰਮੋਨੀਅਮ ਅਤੇ ਰੋਕ ਬੈਂਡ ਵਜਾਉਣ ਦਾ ਬਹੁਤ ਚਾਅ ਰਿਹਾ ਵਾ ਅਤੇ ਅੱਜ ਵੀ ਮੈਂ ਉਸ ਚਾਅ ਨੂੰ ਬਰਕਰਾਰ ਰੱਖਣ ਲਈ ਮੈਂ ਆਪਣੀ ਪੜ੍ਹਾਈ ਨਾਲ ਸਮਝੌਤਾ ਨਹੀਂ ਕੀਤਾ ਜੇਕਰ ਆਪਾਂ ਗੱਲ ਕਰੀਏ ਮੇਰੀ ਪੜ੍ਹਾਈ ਦਾ ਤਾਂ ਮੈਂ ਸਵੇਰੇ ਸ਼ਾਮ ਤੱਕ ਮੈਂ ਪੜ੍ਹਾਈ ਕਰਦਾ ਅਤੇ ਨਾਲੇ ਰਾਤ ਨੂੰ ਸੰਗੀਤ ਰਾਹੀਂ ਆਪਣੇ ਦਿਮਾਗ ਨੂੰ ਵੀ ਸ਼ਾਂਤ ਕਰਦਾ ਵਾ ਔਰ ਜੇਕਰ ਮੈਂ ਗੱਲ ਕਰਾਂ ਆਪਣੇ ਹੋਰ ਪਹਿਲੂਆਂ ਦੇ ਬਾਰੇ ਜਿਵੇਂ ਕਿ ਖੇਡਣਾ ਹੋ ਗਿਆ ਅਤੇ ਖਾਣਾ ਸੌਣਾ ਹੋ ਗਿਆ ਮੈਂ ਉਸ ਨਾਲ ਵੀ ਬਿਲਕੁਲ ਮੈਨੇਜ ਕਰਕੇ ਚੱਲਦਾ ਵਾਂ ਅਤੇ ਨਾਲੇ ਆਪਣੀ ਪੈਸ਼ਨ ਜੋ ਕਿ ਸੰਗੀਤ ਹੈ ਅਤੇ ਨਾਲੇ ਸੰਗੀਤ ਦੇ ਨਾਲ ਜੁੜੇ ਹਰਮੋਨੀਅਮ ਅਤੇ ਰੋਕ ਬੈਂਡ ਉਨ੍ਹਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ